ਹਾਂਜੀ ਮੈਮ ਹਾਂਜੀ ਮੈਮ ਮੈਂ ਹੀ ਕੀਤਾ ਸੀ ਮੈਮ ਮੈਂ ਇਹੀ ਪੁਛਣਾ ਸੀ ਜੀ ਜਿਹੜੀਆਂ ਮੈਂ ਆਨਲਾਈਨ ਸ਼ਰਟਾਂ ਬੁੱਕ ਕਰਵਾਈਆਂ ਨੇ ਉਹ ਮੈਨੂੰ ਕੈਸ਼ ਓਨ ਡਿਲੀਵਰੀ 'ਤੇ ਮਿਲ ਜਾਣਗੀਆਂ ਹਾਂਜੀ ਮੈਮ ਮੈਂ ਵੀ ਕੈਸ਼ ਓਨ ਡਿਲੀਵਰੀ ਕਰਵਾਉਣੀ ਸੀ ਮੈਮ ਜਿਵੇਂ ਕੋਈ ਹੋਰ ਪ੍ਰੋਡਕਟ ਮੰਗਾਉਣਾ ਹੋਵੇ ਤਾਂ ਮੈਨੂੰ ਉਹਦੇ ਤੇ ਡਿਸਕਾਊਂਟ ਮਿਲ ਸਕਦਾ ਠੀਕ ਹੈ ਮੈਮ ਹੋਰ ਮੇਰੀ ਲੋਕੇਸ਼ਨ ਹੈਗੀ ਪੰਜਾਬ ਦੀ ਆ ਲੋਕੇਸ਼ਨ ਪੰਜਾਬ ਸੰਗਰੂਰ ਹਾਂਜੀ ਨਹੀ ਮੈਮ ਹੋਰ ਤਾਂ ਕੁਛ ਨਹੀਂ ਠੀਕ ਹੈ ਮੈਮ ਥੈਂਕ ਯੂ ਮੈਮ